ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਉਹਨਾਂ ਨੇ ਮੈਨੂੰ ਦੱਸਿਆ ਸੀ ਠੀਕ ਹੈ ਠੀਕ ਹੈ ਜੀ ਕਿੱਥੇ ਘੁੰਮਣਾ ਤੁਸੀਂ ਅੱਛਾ ਮੂਵੀ ਇੱਥੇ ਵੈਸੇ ਦੋ ਸਿਨੇਮਾ ਬਹੁਤ ਵਧੀਆ ਨੇ ਇੱਕ ਤਾਂ ਹੈਗਾ ਸਿਨੇਮਾ ਅਤੇ ਦੂਜਾ ਸਕਾਈ ਸਿਨਮਾ ਤੁਸੀਂ ਕਿੱਥੇ ਦੇਖਣੀ ਹੈਗੀ ਦੱਸ ਦਿਓ ਬਾਕੀ ਮੈਂ ਤੁਹਾਡੇ ਨਾਲ ਚਲ ਪਊਂਗੀ ਖੁਦ ਦਿਖਾਉਣ ਜਿੱਥੇ ਕਹੋਂਗੇ ਉੱਥੇ ਘੁੰਮਾਉਣ ਚਲ ਜਾਂਵਾਂਗੇ ਵੈਸੇ ਸਕਾਈ ਸਿਨੇਮਾ ਜਿਹੜਾ ਬਹੁਤ ਵਧੀਆ ਉੱਥੇ ਸਾਰੀ ਫੈਸਿਲਟੀ ਹੈ ਸਕਾਈ ਸਿਨੇਮਾ ਤੁਸੀਂ ਕਿੰਨੇ ਵਾਲਾ ਸ਼ੋਅ ਵੇਖਣਾ ਡੇ ਡੇਅ ਵਾਲਾ ਦੇਖਣਾ ਜਾਂ ਨਾਈਟ ਵਾਲਾ ਸ਼ੋ ਵੇਖਣਾ ਨਾਈਟ ਵਾਲਾ ਨਾਈਟ ਵਾਲਾ ਠੀਕ ਹੈ ਆਪਾਂ ਨੂੰ ਮਿਲ ਜਾਏਗਾ ਸ਼ੋ ਤਾਂ ਪਰ ਪਹਿਲਾਂ ਬੁਕਿੰਗ ਕਰਵਾਉਣੀ ਪੈਣੀ ਹੈ ਟਿਕਟ ਹਾਂ ਕਿੰਨੇ ਜਣੇ ਹੋ ਪੰਜ ਜਣੇ ਹੋ ਠੀਕ ਹੈ ਫਿਰ ਮੈਨੂੰ ਦੱਸ ਦਿਓ ਨਾ ਮੈਂ ਬੁਕਿੰਗ ਕਰਵਾ ਦੂਗੀ ਅਤੇ ਕ ਕਿੱਥੇ ਮਿਲਾਂਗੇ ਉਹ ਵੀ ਦੱਸ ਦਿਓ ਤੁਸੀਂ ਕਿੱਥੇ ਰੁਕੇ ਹੋ ਹੁਣ ਕਿਹੜਾ ਹੋਟਲ ਹੈ ਹਾ ਠੀਕ ਹੈ ਚਲੋ ਫਿਰ ਕੱਲ੍ਹ ਕੱਲ੍ਹ ਮਿਲਦੇ ਹਾਂ ਹਾ ਠੀਕ ਹੈ ਓਕੇ